ਮੈਂ ਕੁਛ ਦਿਨ ਪਹਿਲਾਂ ਹੀ ਆਪਣੇ ਫੋਨ ਵਿੱਚ ਫਲਿੱਕਾਰਟ ਐਪ ਚਲਾ ਰਹੀ ਸੀ ਤਾਂ ਉਸ ਵਿੱਚ ਮੈਨੇ ਦੇਖਿਆ ਕਿ ਨਵੀਂ ਨਵੀਂ ਸਮਾਰਟ ਵੋਚਿਸ ਆ ਰਹੀਆਂ ਸੀ ਤਾਂ ਮੈਨੇ ਸਮਾਰਟ ਵਾਚ ਦੇਖ ਕੇ ਆਪਣਾ ਓਡਰ ਕਰ ਦਿੱਤਾ ਜੋ ਕਿ ਮੈਨੂੰ ਕੱਲ੍ਹ ਹੀ ਰਸੀਵ ਹੋਇਆ ਜਦੋਂ ਮੈਨੇ ਆਪਣੇ ਓਡਰ ਦੇਖਿਆ ਤਾਂ ਬਾਹਰੋਂ ਉਹ ਦੀ ਪੈਕਿੰਗ ਬਹੁਤ ਹੀ ਜ਼ਿਆਦਾ ਖ਼ਰਾਬ ਸੀ ਤਾਂ ਮੈਨੂੰ ਬਹੁਤ ਹੀ ਨਿਰਾਸ਼ਾ ਹੋਈ ਜਦੋਂ ਮੈਨੇ ਆਪਣਾ ਓਡਰ ਓਪਨ ਕੀਤਾ ਤਾਂ ਜਦੋਂ ਮੈਂ ਦੇਖਿਆ ਘੜੀ ਤਾਂ ਬਹੁਤ ਹੀ ਵਿਨ ਕਲਰ ਜਦੋਂ ਮੰਗਾਇਆ ਕਲਰ ਤਾਂ ਮੈਨੇ ਹੋਰ ਮੰਗਾਇਆ ਪਰ ਕਲਰ ਕੋਈ ਹੋਰ ਹੀ ਨਿਕਲਿਆ ਇਸ ਕਰਕੇ ਮੈਨੂੰ ਬਹੁਤ ਹੀ ਨਿਰਾਸ਼ਾ ਹੋਈ ਜਦੋਂ ਮੈਨੇ ਚਲੋ ਮੈਨੇ ਹਿੰਮਤ ਕਰਕੇ ਘੜੀ ਨੂੰ ਆਪਣੇ ਫੋਨ ਨਾਲ ਜਦੋਂ ਕਨੈਕਟ ਕੀਤਾ ਤਾਂ ਉਸ ਦੀ ਟੱਚ ਵੀ ਬਹੁਤ ਹੀ ਬੇਕਾਰ ਨਾਲ ਚੱਲ ਰਹੀ ਸੀਗੀ ਤਾਂ ਉਹਦਾ ਕੈਮਰਾ ਵੀ ਬਹੁਤ ਹੀ ਖ਼ਰਾਬ ਸੀ ਬਹੁਤ ਹੀ ਬਲਰ ਬਲਰ ਫੋਟੋਆਂ ਆ ਰਹੀਆਂ ਸੀ ਇਸ ਕਰਕੇ ਮੈਨੂੰ ਬਹੁਤ ਹੀ ਨਿਰਾਸ਼ਾ ਹੋਈ ਇਸ ਕਰਕੇ ਮੇਰਾ ਫਲਿੱਪਕਾਰਟ ਨਾਲ ਐਕਸਪੀਰੀਐਂਸ ਬਹੁਤ ਹੀ ਵਧਿਆ ਨਹੀਂ ਰਿਹਾ ਤਾਂ ਕਰਕੇ ਮੈਨੇ ਆਪਣੇ ਤਾਂ ਕਰਕੇ ਮੈਨੇ ਆਪਣੇ ਉਹਦੇ ਐਡ ਪੇਮੈਂਟ ਵੀ ਕਰੀ ਹੋਈ ਸੀਗੀ ਜੋ ਕਿ ਬਜਾਰ ਵਿੱਚ ਸਸਤੀ ਸੀ ਇਸ ਕਰਕੇ ਮੈਨੇ ਫਲਿੱਪਕਾਰਟ ਤੋਂ ਮਹਿੰਗੀ ਵੀ ਮੰਗਵਾਈ ਸੀ ਇਸ ਕਰਕੇ ਮੇਰੇ ਘਰ ਦਿਆਂ ਤੋਂ ਵੀ ਮੈਨੂੰ ਬਹੁਤ ਹੀ ਡਾਂਟ ਪਈ ਤਾਂ ਕਰਕੇ ਮੇਰਾ ਐਕਸਪੀਰੀਐਂਸ ਇੰਨਾ ਵਧੀਆ ਨਹੀਂ ਰਿਹਾ ਮੈਨੂੰ ਉਮੀਦ ਹੈ ਕਿ ਵੀ ਤੁਸੀਂ ਮੇਰੇ ਪੈਸੇ ਰਿਫੰਡ ਕਰੋਂਗੇ ਮੈਂ ਆਸ਼ਾ ਕਰਦੀ ਹਾਂ ਕਿ ਤੁਸੀਂ ਮੇਰੇ ਪੈਸੇ ਜਲਦੀ ਤੋ ਜਲਦੀ ਰਿਫੰਡ ਕਰ ਦਿਉ